ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਦੀ ਰਹਿਣ ਵਾਲੀ ਵਾਸੀ ਹਾਂ ਸਾਡੇ ਘਰ ਬਿਜਲੀ ਆਉਂਦੀ ਜਾਂਦੀ ਰਹਿੰਦੀ ਹੈ ਜਿਵੇਂ ਚੌਵੀ ਘੰਟਿਆਂ 'ਚੋਂ ਵੀਹ ਘੰਟੇ ਤਾਂ ਬਿਜਲੀ ਹੁੰਦੀ ਹੈ ਅਤੇ ਚਾਰ ਘੰਟੇ ਅਕਸਰ ਨਹੀਂ ਹੁੰਦੀ ਅਤੇ ਸ਼ਨੀ ਐਤਵਾਰ ਵਾਲੇ ਦਿਨ ਤਾਂ ਸਾਡੇ ਘਰ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਨੇ ਅਤੇ ਜਿਸ ਕਾਰਨ ਸਾਨੂੰ ਬਹੁਤ ਪ੍ਰੇਸ਼ਾਨੀਆਂ ਹੁੰਦੀਆਂ ਹਨ ਜਿਵੇਂ ਕਿ ਕੱਪੜੇ ਧੋਣ ਦੇ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਨਹੀਂ ਚੱਲਦੀ ਅਤੇ ਭਾਂਡੇ ਮਾਂਜਣ ਵਿੱਚ ਪਾਣੀ ਨਹੀਂ ਆਉਂਦਾ ਪਾਣੀ ਮੋਟਰ ਨਾਲ ਆਉਂਦਾ ਹੈ ਅਤੇ ਮੋਟਰ ਵੀ ਫਿਰ ਬਿਨਾਂ ਬਿਜਲੀ ਤੋਂ ਨਹੀਂ ਚੱਲਦੀ ਅਤੇ ਦੂ ਜੇ ਅਸੀਂ ਕਿਸੇ ਮੀਟਿੰਗ ਵਾਸਤੇ ਤਿਆਰ ਹੋਣਾ ਹੋਵੇ ਤਾਂ ਉਹ ਵੀ ਅਸੀਂ ਤਿਆਰ ਹੋ ਨਹੀਂ ਹੋ ਸਕਦੇ ਕਿਉਂਕਿ ਪਾਣੀ ਚਾਹੀਦਾ ਹੈ ਉਸ ਵਾਸਤੇ ਵੀ ਅਤੇ ਸਾਡੇ ਕੱਪੜੇ ਵੀ ਕਈ ਵਾਰ ਪ੍ਰੈਸ ਨਹੀਂ ਹੋਏ ਹੁੰਦੇ ਅਤੇ ਜਿਸ ਕਾਰਨ ਅਸੀਂ ਆਪਣੇ ਜ਼ਰੂਰੀ ਕੰਮਾਂ ਵਾਸਤੇ ਵੀ ਰਹਿ ਜਾਂਦੇ ਹਾਂ ਅਤੇ ਕਈ ਵਾਰ ਜਿਵੇਂ ਬੱਚਿਆਂ ਦੀ ਵਿਦਿਆਰਥੀਆਂ ਦੀ ਕਲਾਸਾਂ ਹੁੰਦੀਆਂ ਹਨ ਔਨਲਾਈਨ ਕਲਾਸਾਂ ਹੁੰਦੀਆਂ ਹਨ ਅਤੇ ਉਨ੍ਹਾਂ ਬਾਰੇ ਉਨ੍ਹਾਂ ਦੀ ਵੀ ਕਲਾਸਾਂ ਰਹਿ ਜਾਂਦੀਆਂ ਹਨ ਕਿਉਂਕਿ ਨੈੱਟ ਵਾਇਫਾਇ ਵੀ ਚਲ ਜਾਂਦਾ ਹੈ ਸਾਨੂੰ ਤਾਂ ਬਹੁਤ ਪ੍ਰੇਸ਼ਾਨੀਆਂ ਆਉਂਦੀਆਂ ਹਨ ਜਦੋਂ ਹੈ ਬਿਜਲੀ ਚਲ ਜਾਂਦੀ ਹੈ ਅਤੇ ਦੂਜਾ ਜਦੋਂ ਮੌਸਮ ਖਰਾਬ ਹੋਵੇ ਅਤੇ ਜਦੋਂ ਬਿਜਲੀ ਕੜਕਦੀ ਹੋਵੇ ਅਤੇ ਬਾਰਿਸ਼ ਦਾ ਮੌਸਮ ਹੋਵੇ ਤਾਂ ਤੁਹਾਡੇ ਸਾਡੇ ਘਰ ਸਾਰੀ ਸਾਰੀ ਰਾਤ ਸਾਰੀ ਸਾਰਾ ਦਿਨ ਬਿਜਲੀ ਨਹੀਂ ਆਉਂਦੀ ਜਿਸ ਕਾਰਨ ਸਾਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਸਾਨੂੰ ਕਈ ਵਾਰ ਤਾਂ ਮਤਲਬ ਬਹੁਤ ਔਖੇ ਹੋ ਕੇ ਅਸੀਂ ਸੋਂਦੇ ਹਾਂ ਅਤੇ ਮੱਛਰ ਵਗੈਰਾ ਵੀ ਫਿਰ ਉਸ ਕਾਰਨ ਬਹੁਤ ਜ਼ਿਆਦਾ ਹੋ ਜਾਂਦੇ ਹਨ ਅਤੇ ਦੂਜਾ ਜਦੋਂ ਗਰਮੀਆਂ ਹੁੰਦੀਆਂ ਹਨ ਤਾਂ ਉਦੋਂ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਆਉਂਦੀ ਹੈ ਕਿਉਂਕਿ ਜਦੋਂ ਬਿਜਲੀ ਨਾ ਹੋਣ ਕਾਰਨ ਪੱਖੇ ਏ ਸੀ ਲਾਈਟਾਂ ਸਭ ਕੁਛ ਬੰਦ ਹੋ ਜਾਂਦਾ ਹੈ ਅਤੇ ਰਾਤ ਨੂੰ ਸੋ ਤੱਕ ਨਹੀਂ ਹੁੰਦਾ ਅਤੇ ਗਰਮੀਆਂ 'ਚ ਬਿਨਾਂ ਏ ਸੀ ਬਿਨਾਂ ਪੱਖੇ ਤੋਂ ਰਹਿਣਾ ਤਾਂ ਬਹੁਤ ਔਖਾ ਕੰਮ ਹੈ ਅਤੇ ਮੈਂ ਜਦੋਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਬਿਜਲੀ ਭਾਵੇਂ ਛੇ ਸੌ ਯੂਨਿਟ ਮਾਫ਼ ਹੋਏ ਨੇ ਪਰ ਕਈ ਵਾਰ ਇੱਦਾਂ ਸਾਨੂੰ ਦੁਰਘਟਨਾ ਆਉਂਦੀ ਹੈ ਕਿ ਬਿਨਾਂ ਦੱਸੇ ਬਿਜਲੀ ਦੇ ਕੱਟ ਲੱਗਦੇ ਹਨ ਅਤੇ ਮੈਂ ਇਹ ਸੁਧਾਰ ਚਾਹੁੰਦੀ ਹਾਂ ਵੀ ਬਿਜਲੀ ਦੇ ਕੱਟ ਲ ਦੱਸ ਕੇ ਲੱਗੇ ਜਾਂ ਸ ਇਸ ਜਿਸ ਕਾਰਨ ਅਸੀਂ ਆਪਣਾ ਸਾਰਾ ਬੰਦੋਬਸਤ ਕਰਕੇ ਅਰਾਮ ਨਾਲ ਬੈਠ ਜਾਈਏ ਵੀ ਪਾਣੀ ਭਰ ਲਈਏ ਆਪਣਾ ਅਤੇ ਕੱਪੜੇ ਵਗੈਰਾ ਧੋ ਲਈਏ ਚੰਗੀ ਤਰ੍ਹਾਂ ਅਤੇ ਸਾਰਾ ਕੰਮ ਆਪਣਾ ਕਰ ਲਈਏ ਅਤੇ ਗਰਮੀਆਂ ਦੀ ਤਾਂ ਚਲੋ ਮੁਸੀਬਤ ਰਹਿਣੀ ਹੈ ਅਤੇ ਸਰਦੀਆਂ ਦੌਰਾਨ ਸਾਨੂੰ ਥੋੜ੍ਹੀ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਜਿਵੇਂ ਰਹਿਣ ਵਿੱਚ ਕਿ ਇਹ ਹੀਟਰ ਵਗੈਰਾ ਸਾਨੂੰ ਚਾਹੀਦੇ ਹੁੰਦੇ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਠੰਡੀ ਜਗ੍ਹਾ 'ਤੇ ਰਹਿੰਦੇ ਹਾਂ ਕਪੂਰਥਲਾ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਅਤੇ ਜਿਸ ਕਾਰਨ ਸਾਨੂੰ ਹੀਟਰ ਦੀ ਲੋੜ ਪੈਂਦੀ ਹੈ ਅਤੇ ਸਰਦੀਆਂ ਵਿੱਚ ਵੀ ਹੀਟਰ ਬੰਦ ਹੋ ਜਾਂਦੇ ਹਨ ਬਿਜਲੀ ਨਾ ਹੋਣ ਕਾਰਨ ਧੰਨਵਾਦ